ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਠੀਕ ਹੈ ਇੱਕ ਪੰਜ ਦੋ ਹਜ਼ਾਰ ਪੰਦਰਾਂ ਲਾਗੇ ਆ ਗਿਆ ਦਸ ਤਿੰਨ ਅਠਾਸੀ ਪੰਜ ਸੱਤ ਦੋ ਹਜ਼ਾਰ ਚੌਦਾਂ ਠੀਕ ਹੈ ਅਠਾਈ ਪੰਜ ਦੋ ਹਜ਼ਾਰ ਚੌਵੀ